ਸੋ ਕਾਰੋਬਾਰ ਸ਼ੁਰੂ ਕਰਦੇ ਸਮੇਂ ਪੇਂਡੂ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਜਾਂ ਫਿਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਸਭ ਤੋਂ ਪਹਿਲਾਂ ਬਜਟ ਹੁੰਦਾ ਹੈ ਜੋ ਕਿ ਲੋਕਾਂ ਨੂੰ ਫੇਸ ਕਰਨਾ ਪੈਂਦਾ ਕਈਆਂ ਕੋਲ ਇੰਨਾ ਬਜਟ ਹੀ ਨਹੀਂ ਹੁੰਦਾ ਕਿ ਉਹ ਆਪਣਾ ਕੰਮ ਸ਼ੁਰੂ ਕਰ ਪਾਉਣ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਉਹ ਹੁੰਦੀ ਹੈ ਸਕਿੱਲਸ ਦੀ ਪੇਂਡੂ ਲੋਕਾਂ ਕੋਲ ਇੰਨੀਆਂ ਸਕਿੱਲਸ ਹੀ ਨਹੀਂ ਹੁੰਦੀਆਂ ਕਿ ਉਹ ਆਪਣਾ ਕੰਮ ਸ਼ੁਰੂ ਕਰ ਪਾਉਣ ਉਹਨਾਂ ਕੋਲ ਨਾ ਹੀ ਕੋਈ ਕਮਿਊਨੀਕੇਸ਼ਨ ਸਕਿੱਲ ਹੁੰਦੀ ਹੈ ਨਾ ਹੀ ਉਹ ਆਪਣੇ ਕਿਸੇ ਗ੍ਰਾਹਕ ਨਾਲ ਡੀਲ ਕਰ ਸਕਦੇ ਹਨ ਅਤੇ ਉਹਨਾਂ ਨੂੰ ਨਵੀਂ ਟੈਕਨੋਲੋਜੀ ਬਾਰੇ ਵੀ ਕੁਝ ਪਤਾ ਨਹੀਂ ਹੁੰਦਾ ਸੋ ਇਹ ਸਭ ਜਿਹੜੀਆਂ ਚੀਜ਼ਾਂ ਹਨ ਉਹ ਕਿਸੇ ਬੰਦੇ ਵਿੱਚ ਜੋ ਕਿ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਇੱਕ ਅੜਚਨ ਦਾ ਕੰਮ ਕਰਦੀਆਂ ਹਨ ਪੇਂਡੂ ਭਾਰਤ ਦੇ ਕਾਰੋਬਾਰਾਂ ਨੂੰ ਸਮਰਥਨ ਦੇਣ ਲਈ ਸਾਡੀ ਗੌਰਮੈਂਟ ਨੂੰ ਹੈਲਪ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਫ੍ਰੀ ਕਲਾਸਿਸ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਹਨ ਜਿਹਦੇ ਵਿੱਚ ਉਹ ਟੈਕਨੋਲੋਜੀ ਸਕਿੱਲਸ ਬਾਰੇ ਲੋਕਾਂ ਨੂੰ ਦੱਸਣ ਅਤੇ ਉਹਨਾਂ ਨੂੰ ਵੀ ਅਵੇਅਰਨੈੱਸ ਹੋਵੇ ਅਤੇ ਉਹ ਆਪਣੇ ਕੰਮ ਸ਼ੁਰੂ ਕਰ ਪਾਉਣ